ਹੈਲੋ ਤੁਸੀਂ ਸ਼ਾਮ ਢਾਬੇ ਤੋਂ ਗੱਲ ਕਰ ਰਹੇ ਹੋ ਜੀ ਮੈਂ ਇ ਇਸ ਢਾਬੇ 'ਤੇ ਨਾ ਆਪਣਾ ਔਡਰ ਦਿੱਤਾ ਸੀ ਜੋ ਮੈਂ ਵੈਜੀਟੇਰੀਅਨ ਆ ਕਿ ਤੁਸੀਂ ਨਾਨ ਵੈੱਜ ਭੇਜ ਦਿੱਤਾ ਅਤੇ ਇਸ ਤਾਂ ਇਹ ਇਹ ਤਾਂ ਨਹੀਂ ਹੋਣਾ ਚਾਹੀਦਾ ਨਾ ਜੋ ਔਡਰ ਦਿੱਤਾ ਉਹ ਹੀ ਔਡਰ ਹੀ ਹੋਣਾ ਚਾਹੀਦਾ ਨਾ ਅਤੇ

ਇੱਦਾਂ ਦੀਆਂ ਗਲਤੀਆਂ ਤਾਂ ਜੇ ਰੈਸਟੋਰੈਂਟਾਂ ਵਿੱਚ ਹੋਣ ਲੱਗ ਜਾਣ ਤਾਂ ਇਹ ਤਾਂ ਨਹੀਂ ਹੈ ਨਾ ਔਡਰ ਅਸੀਂ ਹੋਰ ਕਿਸੇ ਦਾ ਕੀਤਾ ਤੁਸੀਂ ਕਰ ਕੁਛ ਹੋਰ ਰਹੇ ਹੋ ਭੇਜ ਕੁਛ ਹੋਰ ਰਹੇ ਹੋ

ਗਲਤ ਔਡਰ ਪਲੀਜ਼ ਇੱਦਾਂ ਦੇ ਔਡਰ ਐਂ ਔਡਰ ਕੀਤੇ ਨੂੰ ਹੋਰ ਥਾਂ ਜਗ੍ਹਾ ਭੇਜਦੇ ਰਹੋਗੇ ਤਾਂ ਐਵੇਂ ਤੁਹਾਡਾ ਨੁਕਸਾਨ ਹੈ ਨਾਲ ਸਾਡਾ ਨੁਕਸਾਨ ਹੈ ਇਵੇਂ ਨਹੀਂ ਭੇਜਣਾ

ਪਲੀਜ਼ ਇਸ ਇਸ ਔਡਰ ਦਾ ਧਿਆਨ ਰੱਖਿਆ ਜਾਵੇ ਇਹ ਕਿਸੇ ਵੀ ਔਡ ਕੋਈ ਵੀ ਔਡਰ ਕਰਦਾ ਕੋਈ ਇਹਦਾ ਧਿਆਨ ਰੱਖਿਆ ਜਾਵੇ ਅਤੇ ਹੁਣ ਅਸੀਂ ਸਾਡੇ ਕੋਈ ਕੰਮ ਨਹੀਂ ਵਿਅਰਥ ਹੈ ਜੀ ਜੀ ਨਹੀਂ ਨਹੀਂ